ਭਾਰਤ ਇੱਕ ਬਹੁਤ ਖੂਬਸੂਰਤ ਦੇਸ਼ ਹੈ ਇੱਥੇ ਸੈਲਾਨੀਆਂ ਦੇ ਘੁੰਮਣ ਫਿਰਨ ਲਈ ਕਈ ਤਰ੍ਹਾਂ ਦੀਆਂ ਜਗ੍ਹਾਵਾਂ ਹਨ ਜੋ ਸੈਲਾਨੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰਦੀਆਂ ਹਨ ਜਿਵੇਂ ਕਿ ਭਾਰਤ ਵਿੱਚ ਪੰਜਾਬ ਵਿੱਚ ਹਰਿਮੰਦਰ ਸਾਹਿਬ ਹੈ ਜਿਸ ਦੇ ਦਰਸ਼ਨ ਕਰਨ ਲਈ ਪੂਰੇ ਵਰਲਡ ਤੋਂ ਲੋਕ ਆਉਂਦੇ ਹਨ ਲੋਕਾਂ ਨੂੰ ਦੇਖ ਕੇ ਬਹੁਤ ਹੀ ਸਕੂਨ ਮਿਲਦਾ ਹੈ ਦਿੱਲੀ ਵਿੱਚ ਲਾਲ ਕਿਲ੍ਹਾ ਦੇਖਣ ਵਾਲਾ ਹੈ ਆਗਰਾ ਵਿੱਚ ਤਾਜ ਮਹੱਲ ਦੇਖਣ ਵਾਲਾ ਹੈ ਜੋ ਭਾਰਤ ਵਿੱਚ ਖਾਸ ਆਕਰਸ਼ਣ ਦਾ ਕਾਰਨ ਹੈ ਰਿਸ਼ੀਕੇਸ਼ ਦੇ ਮੰਦਰ ਵੀ ਦੇਖਣ ਵਾਲੇ ਹਨ ਪਾਂਡੀਚਰੀ ਵੀ ਇੱਕ ਬਹੁਤ ਖੂਬਸੂਰਤ ਸ਼ਹਿਰ ਹੈ ਇਸ ਤੋਂ ਇਲਾਵਾ ਕਈ ਹੋਰ ਸਥਾਨ ਵੀ ਦੇਖਣ ਵਾਲੇ ਹਨ ਜੋ ਸੈਲਾਨੀ ਨੂੰ ਭਾਰਤ ਆਉਣ ਲਈ ਆਕਰਸ਼ਿਤ ਕਰਦੇ ਹਨ